ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਅਸਮਰੱਥਾ ਨਾਲ ਲੜਨ ਲਈ ਕਈ ਉਪਾਏ ਕੀਤੇ ਗਏ ਹਨ ਉਹਨਾਂ ਵਿੱਚੋਂ ਜਿਵੇਂ ਸਮਰੱਥ ਅਤੇ ਅਧਿਆਪਕਾਂ ਦੁਆਰਾ ਸਿੱਖਿਆ ਨੂੰ ਪਹੁੰਚਾਉਣਾ ਵਿਦਿਆਰਥੀਆਂ ਲਈ ਵੱਖਰੇ ਵੱਖਰੇ ਤਰ੍ਹਾਂ ਦੇ ਸਿੱਖਿਆ ਨੂੰ ਪੇਸ਼ਕਸ਼ ਕਰਨਾ ਅਤੇ ਹੋਰ ਸਿੱਖਿਆ ਦੇ ਲਈ ਜਿਵੇਂ ਕੰ ਕਿਤਾਬਾਂ ਕੰਪਿਊਟਰ ਅਤੇ ਇੰਟਰਨੈਟ ਪ੍ਰਦਾਨ ਕਰਨਾ ਹੋਰ ਵਿਦਿਆਰਥੀਆਂ ਦੀ ਸਿੱਖਿਆ ਨੂੰ ਵਧਾਉਣ ਲਈ ਸਿੱਖਿਆ ਦੇ ਤਰੀਕਿਆਂ ਵਿੱਚ ਸੁਧਾਰ ਕਰਨਾ ਹੋਰ ਟੂਟਰਿੰਗ ਹੋਰ ਇਸ ਤਰ੍ਹਾਂ ਦੀ ਪੇਸ਼ਕਸ਼ ਕਰਨਾ ਇਹ ਸਾਰੇ ਮਿਲ ਕੇ ਵਿਦਿਆਰਥੀਆਂ ਨੂੰ ਸਿੱਖਿਆ ਵਿਦਿਆਰਥੀਆਂ ਨੂੰ ਸਮਰੱਥ ਬਣਾਉਂਦੇ ਹਨ ਸ ਧੰਨਵਾਦ